ਭਾਜੀ ਨਾ ਤੁਸੀਂ ਕਿੰਨੀਆਂ ਬੁਕਸਾਂ ਲੈਣੀਆਂ ਨੇ ਤੁਸੀਂ ਅਗਲੇ ਸਮੈਸਟਰ ਦੀਆਂ

ਜੀ ਪ੍ਰਧਾਨ ਜੀ ਅੱਛਾ ਵੈਸੇ ਇਹ ਦੋਨਾਂ ਬੁੱਕਾਂ ਦਾ ਤੁਹਾਨੂੰ ਚਾਰ ਸੌ ਜਾਂ ਸਾਢੇ ਚਾਰ ਸੌ ਦੇ ਵਿੱਚ ਮਿਲ ਜਾਣਗੀਆਂ ਅਤੇ ਰਹੀ ਗੱਲ ਰਹੀ ਗੱਲ ਹਾਂਜੀ

ਅੱਛਾ ਤੁਸੀਂ ਇਕ ਹਜ਼ਾਰ ਸੌ ਤੱਕ ਮਤਲਬ ਚਾਰ ਤੁਹਾਨੂੰ ਮੈਂ ਸਾਢੇ ਚਾਰ ਸੌ ਕਹਿੰਦਾ ਤਾਂ ਤੁਸੀਂ ਸਾਢੇ ਤਿੰਨ ਸੌ ਦੇ ਦਿਓ ਪਹਿਲਾਂ

ਕੋਈ ਨਾ ਉਹ ਵੀ ਐਵੇਂ ਰੇਟ ਦੀ ਆ ਜੂਗੀ ਟੈਂਸ਼ਨ ਨਾ ਲਓ ਵੈਸੇ ਤੁਸੀਂ ਜਿਹੜੀ ਪੁਰਾਣੀਆਂ ਬੁੱਕਾਂ ਹੈਗੀਆਂ ਨੇ ਫਾੜੀਆਂ ਤਾਂ ਨਹੀਂ ਕਿਤੇ ਪਹਿਲਾਂ ਆਪਾਂ ਸਰਾਈ ਕਰ ਦਾਂਗੇ ਤੁਸੀਂ ਤੁਹਾਡੇ ਕੋਲ ਬਿੱਲ ਹੋਊਗਾ ਉਹਦਾ ਜਿਹੜਾ ਪੱਕਾ ਲਾਇਆ ਗਾ

ਹਾਂ ਹੈਗੇ ਆ ਬਸ ਬਸ ਪਰ ਸੈਚਰਡੇ ਮੈਨੂੰ ਜ਼ਰੂਰੀ ਹੈਗਾ ਪਰ ਦੋ ਵਜੇ ਤੱਕ ਤਾਂ ਹੈਗਾ ਵਾਂ ਮੈਂ ਠੀਕ ਹੈ ਅਤੇ ਐਂ ਤੇ ਉਹ ਜਿਹੜਾ ਬਿਲ ਮਿਲਿਆ ਉਤਾਂਹ ਲੈ ਆਇਓ ਬਿਲ ਠੀਕ ਹੈ ਨਾ ਵੀ ਕਈ ਵਾਰ ਇਹ ਬੁੱਕਾਂ ਦੇ ਵਿੱਚ ਜਿਹੜਾ ਰੇਟ ਲਿਖਿਆ ਹੁੰਦਾ ਨਾ ਸਹੀ ਨਹੀਂ ਦਿਖਦਾ ਹਾਂਜੀ ਸੈਚਰਡੇ ਨੂੰ ਆ ਜਿਓ ਸੈਚਰਡੇ ਨੂੰ ਆ ਜਿਓ ਦੋ ਵਜੇ ਤੋਂ ਪਹਿਲੇ ਪਹਿਲੇ